ਖੂਹ ਵਿੱਚੋਂ ਪਾਣੀ ਕੱਢਣ ਲਈ ਸਭ ਤੋਂ ਪਹਿਲਾਂ ਸਾਨੂੰ ਇੱਕ ਰੱਸੀ ਅਤੇ ਇੱਕ ਬਾਲਟੀ ਦੀ ਜ਼ਰੂਰਤ ਹੁੰਦੀ ਹੈ ਇਸ ਨਾਲ ਅਸੀਂ ਕੀ ਕਰਦੇ ਹਾਂ ਰੱਸੀ ਨੂੰ ਬਾਲਟੀ ਨਾਲ ਬੰਨ ਕੇ ਤੇ ਖੂਹ ਵਿੱਚ ਸੁੱਟ ਦਿੰਦੇ ਹਾਂ ਅਤੇ ਜਦੋਂ ਬਾਲਟੀ ਪਾਣੀ ਨਾਲ ਭਰ ਜਾਂਦੀ ਆ ਤਾਂ ਖਿੱਚ ਲੈਂਦੇ ਹਾਂ ਇਹ ਸਾਡਾ ਪੁਰਾਣਾ ਤਰੀਕਾ ਹੈ ਜੇਕਰ ਅੱਜ ਕੱਲ੍ਹ ਅਸੀਂ ਆਧੁਨਿਕ ਸਮੇਂ ਵਿੱਚ ਰਹਿ ਰਹੇ ਹਾਂ ਜਿੱਥੇ ਹਰ ਚੀਜ਼ ਇੱਕ ਮਸ਼ੀਨੀ ਤਰੀਕੇ ਨਾਲ ਇਸਤੇਮਾਲ ਕੀਤੀ ਜਾਂਦੀ ਹੈ ਤਾਂ ਆਪਾਂ ਇਸ ਤਰੀਕੇ ਨੂੰ ਵੀ ਮਸ਼ੀਨੀ ਵਿੱਚ ਅਪ ਬਦਲ ਸਕਦੇ ਹਾਂ ਜਿਵੇਂ ਆਪਾਂ ਕੀ ਕਰ ਸਕਦੇ ਹਾਂ ਆਪਾਂ ਖੂਹ ਦੇ ਵਿੱਚ ਮੋਟਰ ਲਗਾ ਸਕਦੇ ਹਾਂ ਜਿਸ ਨਾਲ ਕੀ ਹੋਏਗਾ ਕਿ ਪਾਣੀ ਖੁਦ ਤੇ ਖੁਦ ਮੋਟਰ ਜਦੋਂ ਆਪਾਂ ਚਲਾਵਾਂਗੇ ਤਾਂ ਉੱਪਰ ਆ ਜੇਗਾ ਠੀਕ ਹੈ ਜਿਵੇਂ ਆਪਾਂ ਬੋਰਵੈਲ ਵਿੱਚ ਕਰਦੇ ਹਾਂ ਬੋਰਿੰਗ ਕਰਦੇ ਹਾਂ ਅਤੇ ਉਹਦੇ ਵਿੱਚ ਆਪਾਂ ਇੱਕ ਮਸ਼ੀਨ ਪਾਉਂਦੇ ਹਾਂ ਜਿਹਨੂੰ ਆਪਾਂ ਮੋਟਰ ਕਹਿੰਦੇ ਹਾਂ ਅਤੇ ਜਦੋਂ ਮੋਟਰ ਚਲਾਉਂਦੇ ਹਾਂ ਤਾਂ ਪਾਣੀ ਆਪਣੇ ਆਪ ਉੱਪਰ ਨੂੰ ਆਉਂਦਾ ਹੈ ਜਾਂ ਦੂਸਰਾ ਤਰੀਕਾ ਕੀ ਹੈ ਆਪਾਂ ਮੋਟਰ ਨੂੰ ਬਾਹਰ ਰੱਖਦੇ ਹਾਂ ਅਤੇ ਉਹਦੇ ਆਲੇ ਦੁਆਲੇ ਇੱਕ ਟਰਾਈਬ ਜਿਹੀ ਲਗਾ ਦਿੰਦੇ ਹਾਂ ਜਿਹਦੇ 'ਚ ਬਾਲਟੀਆਂ ਹੁੰਦੀਆਂ ਵਾ ਜਿਵੇਂ ਕਿ ਛੇ ਛੇ ਕੁ ਬਾਲਟੀਆਂ ਭਰ ਸਕਦੇ ਹਾਂ ਜਿਵੇਂ ਛਿਆਟਾ ਗੁਰਦੁਆਰੇ ਵਿੱਚ ਵੀ ਆਪਾਂ ਦੇਖ ਸਕਦੇ ਹਾਂ ਕਿ ਉਦੋਂ ਜ਼ਮਾਨੇ ਦੇ ਵਿੱਚ ਵੀ ਇਸ ਤਰ੍ਹਾਂ ਦੀ ਇੱਕ ਤਕਨੀਕ ਹੈਗੀ ਸੀ ਅਤੇ ਉਸ ਨਾਲ ਕੀ ਹੋਏਗਾ ਆਪਾਂ ਇੱਕ ਬਾਲਟੀ ਦੇ ਬਜਾਇ ਕਿ ਛੇ ਛੇ ਬਾਲਟੀਆਂ ਪਾਣੀ ਦੀਆਂ ਇੱਕ ਸਾਥ ਆ ਜਾਂਦੀ ਆ ਸਾਡੇ ਕੋਲ ਠੀਕ ਹੈ ਹੋਰ ਵੀ ਆਪਾਂ ਕਈ ਤਰੀਕੇ ਯੂਜ ਕਰ ਸਕਦੇ ਹਾਂ ਅਸੀਂ ਬਾਹਰ ਮੋਟਰ ਲਗਾ ਕੇ ਠੀਕ ਹੈ ਬਾਹਰ ਮੋਟਰ ਲਗਾ ਕੇ ਆਪਾਂ ਇੱਕ ਇੱਦਾਂ ਦਾ ਸਿਸਟਮ ਤਿਆਰ ਕਰ ਦਿੰਦੇ ਹਾਂ ਕਿ ਜਿਹਦੇ ਨਾਲ ਕੀ ਹੋਏਗਾ ਪਾਣੀ ਆਪਣੇ ਆਪ ਬਾਹਰ ਆਉਣਾ ਸਟਾਰਟ ਹੋ ਜੇਗਾ ਅ ਸਾਨੂੰ ਮਿਹਨਤ ਨਹੀਂ ਕਰਨੀ ਪਏਗੀ ਜਿਵੇਂ ਆਪਾਂ ਮਿਹਨਤ ਕਰਦੇ ਹਾਂ ਰੱਸੀ ਨੂੰ ਪਾਉਣ ਦੀ ਫਿਰ ਰੱਸੀ ਨੂੰ ਖਿੱਚ ਕੇ ਪਾਣੀ ਕੱਢਣ ਦੀ ਉਹ ਮਿਹਨਤ ਸਾਡੀ ਬਚ ਜੇਗੀ ਜਿਸ ਨਾਲ ਬਹੁਤ ਹੀ ਆਸਾਨੀ ਨਾਲ ਆਪਾਂ ਕੀ ਕਰ ਸਕਦੇ ਹਾਂ ਖੂਹ ਵਿੱਚੋਂ ਜਾਂ ਟਿਊਬਵੈਲ ਵਿੱਚੋਂ ਪਾਣੀ ਆਰਾਮ ਨਾਲ ਕੱਢ ਸਕਦੇ ਹਾਂ ਧੰਨਵਾਦ